ਮੇਰਾ ਸਥਾਨਕ ਬੈਂਕ ਜਿਹੜਾ ਹੈ ਉਹ ਐਚ ਡੀ ਐਫ ਸੀ ਹੈ ਅਤੇ ਐਕਸਿਸ ਹੈ ਉਹ ਸਾਨੂੰ ਅੱਜ ਤੱਕ ਉਸ ਬੈਂਕਾਂ ਦੇ ਵਿੱਚ ਕੋਈ ਵੀ ਅਰਜ਼ੀ ਨਹੀਂ ਦੇਣੀ ਪਈ ਸਾਡੇ ਮਿਊਚਲ ਫੰਡ ਕਰਜ਼ੇ ਜੇ ਵੋ ਵਾਸਤੇ ਹਮੇਸ਼ਾ ਆਪ ਹੀ ਫੋਨ ਕਰਕੇ ਪੁੱਛਦੇ ਰਹਿੰਦੇ ਹਨ ਪਰ ਅੱਜ ਤੱਕ ਸਾਨੂੰ ਕਦੇ ਵੀ ਕੋਈ ਇਸ ਤਰ੍ਹਾਂ ਦੀ ਕਰਜ਼ੇ ਦੀ ਲੋੜ ਨਹੀਂ ਪਈ ਅਸੀਂ ਹਮੇਸ਼ਾ ਹਰ ਚੀਜ਼ ਕੈਸ਼ ਲੈਂਦੇ ਹਾਂ ਮਿਊਚਲ ਫੰਡ ਦੇ ਵਿੱਚ ਅਸੀਂ ਬਹੁਤ ਪੈਸਾ ਇਨਵੈਸਟ ਕਰਦੇ ਹਾਂ ਅਤੇ ਕਾਰਡ ਕਾਰਡ ਦਾ ਵੀ ਅਸੀਂ ਪ੍ਰਯੋਗ ਕਰਦੇ ਹਨ ਕਾਰਡ ਹੋਣ ਕਰਕੇ ਸਾਨੂੰ ਪੈਸੇ ਜਿਹੜੇ ਨੇ ਨਾਲ ਨਹੀਂ ਰੱਖਣੇ ਪੈਂਦੇ ਆ ਅਤੇ ਜਿੱਥੇ ਲੋੜ ਪਵੇ ਉਹ ਕਾਰਡ ਦਾ ਇਸਤੇਮਾਲ ਕਰ ਲੈਂਦੇ ਹਾਂ ਅਤੇ ਸਾਡਾ ਬੈਂਕ ਜਿਹੜਾ ਹੈ ਸਾਨੂੰ ਸਾਨੂੰ ਹਮੇਸ਼ਾ ਹੀ ਉਹ ਸਹਾਇਤਾ ਕਰਦਾ ਹੈ ਅਗਰ ਇਨ ਕੇਸ ਕੋਈ ਪ੍ਰੋਬਲਮ ਆ ਜਾਂਦੀ ਹੈ ਤਾਂ ਅਸੀਂ ਬੈਂਕ ਦੇ ਸਹਾਇਕ ਕੋਲ ਜਾ ਕੇ ਕੁਛ ਕਹਿੰਦੇ ਹਾਂ ਅਤੇ ਉਸ ਵੇਲੇ ਉਹ ਸਾਡੀ ਸਮੱਸਿਆ ਦਾ ਹੱਲ ਕਰ ਦਿੰਦੇ ਨੇ ਅੱਜ ਤੱਕ ਇੱਕ ਅੱਧੀ ਕਦੇ ਇੰਨੇ ਸਾਲਾਂ ਦੇ ਵਿੱਚ ਕਦੇ ਇੱਕ ਅੱਧੀ ਵਾਰ ਅਰਜ਼ੀ ਦੇਣ ਦੀ ਲੋੜ ਪਈ ਹੈ ਨਹੀਂ ਤਾਂ ਅੱਜ ਕੱਲ੍ਹ ਲੋੜ ਹੀ ਨਹੀਂ ਪੈਂਦੀ ਉਹ ਆਪਣੇ ਆਪ ਫੋਨ 'ਤੇ ਅਪਡੇਟ ਲੈਂਦੇ ਰਹਿੰਦੇ ਹਨ